ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਹਾਂਜੀ ਮੈਮ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਹਾਂ ਮੈਂ ਤੁਹਾਡਾ ਹਰ ਇੱਕ ਗਾਣੇ ਵਗੈਰਾ ਸਾਰੇ ਸੁਣੇ ਆ ਹਾਂ ਹਾਂ ਮੈਮ ਫਿਰ ਮੈਨੂੰ ਇਹਨਾਂ ਦੱਸਿਓ ਕਿ ਹੁਣ ਤੁਹਾਡਾ ਅਗਲਾ ਸ਼ੋਅ ਕਿੱਥੇ ਲੱਗਣਾ ਵਾ ਅੱਛਾ ਅੱਛਾ ਅਤੇ ਮੈਮ ਉਹਦੀ ਕਿੰਨੀ ਕੁ ਟਾਈਮਿੰਗ ਆ ਅਤੇ ਟਾਈਮਿੰਗ ਕਿੰਨੀ ਆ ਅਤੇ ਕਿੰਨੀ ਫੀਸ ਆ

ਅੱਛਾ ਅਤੇ ਫੀਸ ਹਾਂਜੀ ਮੈਮ ਅਤੇ ਮੈਮ ਮੈਨੂੰ ਅਗਲੇ ਸੋ ਸ਼ੋਅ ਦਾ ਬਹੁਤ ਜ਼ਿਆਦਾ ਵੇਟ ਆ ਅਤੇ ਮੈਂ ਅਗਲੇ ਸ਼ੋਅ ਦੇ ਮੈਨੂੰ ਮਤਲਬ ਕਿ ਟਾਈਮਿੰਗ ਅਤੇ ਅਗਲਾ ਜੋ ਵੀ ਹੋਏਗਾ ਅ ਗਾਣਾ ਨਵਾਂ ਤੁਹਾਡਾ ਵੇ ਮੈਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਿ ਵਧੀਆ ਹੋਏ ਹਾਂ ਥੈਂਕਯੂ ਥੈਂਕਯੂ ਮੈਮ